ਹਾਂਜੀ ਮੈਂ ਔਨਲਾਈਨ ਸ਼ੋਪਿੰਗ ਵੀ ਕੀਤੀ ਹੈ ਕਿ ਮੈਂ ਆਪਣੇ ਲਈ ਨਾ ਕੋਈ ਬਹੁਤ ਵਧੀਆ ਕੁੜਤੀ ਅਤੇ ਟੋਪ ਮੰਗਵਾਉਣਾ ਚਾਹੁੰਦੀ ਸੀ ਜਿਹੜੇ ਕਿ ਮੈਂ ਫਲਿੱਪਕਾਰਟ ਤੋਂ ਜਿਹੜੇ ਔਨਲਾਈਨ ਅਪਲਾਈ ਕੀਤੇ ਅਤੇ ਬਹੁਤ ਹੀ ਘੱਟ ਰੇਟ 'ਤੇ ਬਹੁਤ ਹੀ ਵਧੀਆ ਫੈਬਰਿਕ ਜੋ ਹੈ ਮੈਨੂੰ ਮਿਲਿਆ ਉਹਦੇ ਵਿੱਚ ਮੈਂ ਜਿੱਥੇ ਕਿ ਆਪਾਂ ਆਮ ਖਰੀਦਦੇ ਹਾਂ ਤਾਂ ਸਾਨੂੰ ਬਹੁਤ ਮਹਿੰਗਾ ਮਿਲਦਾ ਜਿਹਦੇ ਲਈ ਸਾਨੂੰ ਸਿਲਾਈ ਦੇ ਪੈਸੇ ਦੇਣੇ ਪੈਂਦੇ ਹੈ ਤਾਂ ਫੈਬਰਿਕ ਜੋ ਹੈ ਵੱਖਰਾ ਲੈਣਾ ਪੈਂਦਾ ਅਤੇ ਸਿਲਾਈ ਵੀ ਵੱਖਰੀ ਦੇਣੀ ਪੈਂਦੀ ਹੈ ਪਰ ਜਦੋਂ ਅਸੀਂ ਔਨਲਾਈਨ ਓਡਰ ਕਰਦੇ ਹੈ ਜਿਵੇਂ ਕਿ ਮੈਂ ਕੁਛ ਕੁੜਤੀਆਂ ਮੰਗਵਾਈਆਂ ਟੋਪ ਮੰਗਵਾਏ ਉਹ ਬਹੁਤ ਵਧੀਆ ਨਿਕਲੇ ਅਤੇ ਬਹੁਤ ਹੀ ਘੱਟ ਰੇਟ ਦੇ ਨਿਕਲੇ ਜਿੱਥੇ ਕਿ ਮੈਂ ਦੋ ਤਿੰਨ ਕੁੜਤੀਆਂ ਮੰਗਵਾਉਣੀਆਂ ਸੀ ਉੱਥੇ ਮੈਂ ਤਿੰਨ ਚਾਰ ਮੰਗਵਾਈਆਂ ਫਲਿੱਪਕਾਰਟ ਵਾਲਿਆਂ ਦੀ ਜਿਹੜੀ ਹੈ ਉਨ੍ਹਾਂ ਦੀ ਡਿਲੀਵਰੀ ਦਾ ਸਿਸਟਮ ਵੀ ਹੈ ਜੋ ਬਹੁਤ ਵਧੀਆ ਅਤੇ ਜਿਹੜੀ ਸਰਵਿਸ ਵੀ ਉਨ੍ਹਾਂ ਦੀ ਬਹੁਤ ਵਧੀਆ ਜੋ ਪ੍ਰੋਡਕਟ ਹੈ ਉਹਦੇ ਵਿੱਚ ਕੋਈ ਵੀ ਇਹੋ ਜਿਹੀ ਕੋਈ ਗੱਲ ਨਹੀਂ ਹੈ ਕੋਈ ਮਤਲਬ ਘਟੀਆ ਪ੍ਰੋਡਕਟ ਨਹੀਂ ਹੈ ਕੁਛ ਵੀ ਉਹਦੇ ਵਿੱਚ ਇਹ ਨਹੀਂ ਹੈ ਵੀ ਕਲਰ ਫੇਟ ਹੋਣ ਦਾ ਜਾਂ ਫਿਟਿੰਗ ਦੀ ਕੋਈ ਪ੍ਰੋਬਲਮ ਨਹੀਂ ਹੈ ਜਾਂ ਅਸੀਂ ਕਹਿ ਸਕਦੇ ਹਾਂ ਕਿ ਉਹਦੇ ਵਿੱਚ ਸਾਨੂੰ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਆ ਪਰ ਤੁਸੀਂ ਜਿਵੇਂ ਦਾ ਆਪਣਾ ਪ੍ਰੋਡਕਟ ਹੈ ਜੋ ਮੰਗਵਾਉਣਾ ਚਾਹੁੰਦੇ ਹੋ ਤੁਸੀਂ ਓਵੇਂ ਦਾ ਮੰਗਵਾ ਸਕਦੇ ਹੋ ਤਾਂ ਜੋ ਸਾਨੂੰ ਆਮ ਖਰੀਦਣ ਦੇ ਨਾਲੋਂ ਜਿਹੜਾ ਔਨਲਾਈਨ ਖਰੀਦਣ ਦਾ ਸਿਸਟਮ ਹੈ ਉਹ ਬਹੁਤ ਵਧੀਆ ਰਹਿੰਦਾ ਅਤੇ ਬਹੁਤ ਹੀ ਘੱਟ ਰੇਟ 'ਤੇ ਅਤੇ ਓਫਰ 'ਚ ਵੀ ਸਾਨੂੰ ਜੋ ਚੀਜ਼ਾਂ ਬਹੁਤ ਵਧੀਆ ਚੀਜ਼ਾਂ ਨੇ ਉਹ ਸਾਨੂੰ ਓਫਰ 'ਤੇ ਮਿਲ ਜਾਂਦੀਆਂ ਹਨ ਤਾਂ ਸਾਨੂੰ ਇੱਕ ਦੀ ਬਜਾਏ ਅਸੀਂ ਦੋ ਦੋ ਤਿੰਨ ਤਿੰਨ ਚੀਜ਼ਾਂ ਵੀ ਓਫਰ ਵਿੱਚ ਜਿਹੜੀਆਂ ਉਹ ਖਰੀਦ ਸਕਦੇ ਹਾਂ ਤਾਂ ਮੇਰੇ ਮੁ ਮੁਤਾਬਕ ਔਨਲਾਈਨ ਸ਼ੋਪਿੰਗ ਕਰਨੀ ਬਹੁਤ ਵਧੀਆ ਰਹਿੰਦੀ ਹੈ